ਹੈਲੋ

ਜੀ ਹਾਂਜੀ ਮੈਮ ਦੱਸੋ ਜੀ ਹਾਂਜੀ ਹਾਂਜੀ ਬੋਲੋ

ਹਾਂਜੀ ਹਾਂਜੀ ਉੱਤੇ ਪੋਰਸ ਨਾਲ ਅਟੈਚ ਵਾਸ਼ਰੂਮ ਹੈ ਤੇ ਇੱਕ ਕੀਚਨ ਹੈ ਤੇ ਇੱਕ ਬਾਲਕਨੀ ਹੈ ਬਾਕੀ ਤੁਸੀਂ ਦੱਸ ਦੋ ਤੁਹਾਡੀ ਕੀ ਕੀ ਜਰੂਰਤ ਹੈ ਫਰਨੀਚਰ ਹੋਊਗਾ ਵਿਦ ਹਾਂਜੀ ਹਾਂਜੀ ਹਾਂਜੀ ਪਾਰਕਿੰਗ ਦੀ ਜਗ੍ਹਾ ਵੀ ਮਿਲੂਗੀ ਤੁਹਾਨੂੰ

ਦੇਖੋ ਇਹਦੇ ਤੇ ਇਲੈਕਟਰਿਸਿਟੀ ਦਾ ਅਲੱਗ ਹੋਊਗਾ ਤੁਹਾਡਾ ਮਤਲਬ ਕੀ ਉਹ ਲੱਗਿਆ ਹੋਗਾ ਸਬ ਮੀਟਰ ਹਾਂਜੀ ਹਾਂਜੀ ਉਹ ਤੁਸੀਂ ਅਲੱਗ ਤੋਂ ਆਪਦਾ ਬਿੱਲ ਪੇ ਕਰਿਆ ਕਰੋਗੇ ਜਿੰਨਾ ਵੀ ਹੋਊਗਾ ਤੇ ਬਾਕੀ ਤੁਹਾਨੂੰ ਵਿਦ ਫਰਨੀਚਰ ਮਿਲੂਗਾ ਬੈਡ ਅਲਮੀਰਾ ਉਹ ਮਿਲੂਗਾ ਹਾਂਜੀ ਹਾਂਜੀ

ਵਿਦ ਫਰਨੀਚਰ ਦਾ ਟ੍ਵੇਲਵ ਥਾਉਜ਼ਨ੍ਡ ਹੋਊਗਾ ਪਰ ਮੰਥ ਤੇ ਵਿਦਆਊਟ ਟੈਨ ਥਾਉਜ਼ਨ੍ਡ ਹੋਊਗਾ ਤੁਸੀਂ ਕਿੰਨੇ ਜਣਿਆ ਨੇ ਰਹਿਣਾ ਚਲੋ ਕੋਈ ਨਾ ਤੁਸੀਂ ਰੱਖ ਦੋ ਫਿਰ ਕਿਵੇਂ ਦਸ ਹਜ਼ਾਰ

ਅੱਛਾ ਅੱਛਾ ਚਲੋ ਕੋਈ ਨਾ ਸੇਵੇਨ ਥਾਉਜ਼ਨ੍ਡ ਤਾਂ ਨੀ ਤੁਸੀਂ ਸਾਢੇ ਅੱਠ ਹਜ਼ਾਰ ਦੇ ਦਿਓ ਚਲੋ ਫਿਰ ਤੁਹਾਨੂੰ ਪਾਰਕਿੰਗ ਲਈ ਵੀ ਜਗ੍ਹਾ ਦੇ ਰਹੇ ਹੈ ਇਹ ਵੀ ਮਤਲਬ ਸ਼ਾਇਦ ਚੌਖਾ ਹੀ ਹੁੰਦਾ ਵੈਸੇ ਤਾਂ ਪਾਰਕਿੰਗ ਲਈ ਵੀ ਇਹਦਾ ਦੇ ਨਹੀਂ ਨਹੀਂ ਨਹੀਂ ਮੈਮ ਸਾਡੀ ਘਰ ਦੇ ਨਾਲ ਹੀ ਸਾਡਾ ਖਾਲੀ ਪਲੋਟ ਹੈ ਉਥੇ ਪਾਰਕਿੰਗ ਹੋ ਜਾਂਦੀ ਹਾਂਜੀ ਹਾਂਜੀ ਨਹੀਂ ਨਹੀਂ ਤੁਸੀਂ ਅੱਜ ਸਾਡੇ ਅੱਜ ਤੱਕ ਆਪਾਂ ਕਰ ਲਾਂਗੇ ਹਾਂਜੀ ਠੀਕ ਹੈ ਕੋਈ ਨਾ ਤੁਸੀਂ ਆ ਕੇ ਦੇਖ ਵੀ ਜਾਇਓ ਚਾਹੇ ਓਕੇ